ਹੈਲੋ ਸਤਿ ਸ਼੍ਰੀ ਅਕਾਲ ਜੀ ਉਬਰ ਤੋਂ ਬੋਲ ਰਹੇ ਹੋ ਹਾਂਜੀ ਇੱਕ ਨਾ ਫੀਡਬੈਕ ਦੇਣਾ ਸੀਗਾ ਜੀ ਤੁਹਾਨੂੰ ਮੈਂ ਕੱਲ੍ਹ ਇੱਕ ਕੈਬ ਬੁੱਕ ਕੀਤੀ ਸੀ ਅਤੇ ਮੈਨੂੰ ਬਹੁਤ ਵਧੀਆ ਲੱਗਿਆ ਉਹਨਾਂ ਦਾ ਕੰਮ ਅਤੇ ਬਲਵਿੰਦਰ ਸਿੰਘ ਜੀ ਕਰਕੇ ਸੀਗੇ ਉਹਨਾਂ ਦੀ ਮੈਂ ਕੈਬ ਬੁੱਕ ਕੀਤੀ ਸੀ ਰਾਤ ਸਾਢੇ ਕੁ ਦਸ ਵਜੇ ਦੇ ਨੇੜੇ ਤੇੜੇ ਮੈਨੂੰ ਇੱਕੋ ਦਮ ਐਮਰਜੈਂਸੀ ਪੈ ਗਈ ਸੀ ਹੋਸਪੀਟਲ ਜਾਣਾ ਪੈ ਗਿਆ ਸਾਡੇ ਰਿਸ਼ਤੇਦਾਰ ਸੀਗੇ ਥੋੜ੍ਹਾ ਜਿਹਾ ਉਹ ਬਿਮਾਰ ਹੋ ਗਏ ਸੀ ਅਤੇ ਮੈਂ ਵੀ ਥੋੜ੍ਹਾ ਜਿਹਾ ਘਬਰਾ ਗਿਆ ਇੱਕੋ ਦਮ ਹੋਸਪੀਟਲ ਦਾ ਨਾਮ ਸੁਣ ਕੇ ਤਾਂ ਜਦੋਂ ਮੈਂ ਉਹਨਾਂ ਦੇ ਨਾਲ਼ ਗਿਆ ਤਾਂ ਉਹਨਾਂ ਨੇ ਮੈਨੂੰ ਬੜਾ ਵਧੀਆ ਤਰੀਕੇ ਨਾਲ਼ ਡੀਲ ਕੀਤਾ ਅਤੇ ਮੈਂ ਸਿਰਫ਼ ਉਹਨਾਂ ਨੂੰ ਲੋਕੇਸ਼ਨ ਦੱਸਤੀ ਅਤੇ ਮੈਨੂੰ ਪਤਾ ਨੀ ਸੀ ਕਿਵੇਂ ਕਿੱਧਰ ਨੂੰ ਜਾਣਾ ਤਾਂ ਸਭ ਕੁਝ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ਼ ਡਰਾਈਵ ਕੀਤਾ ਅਤੇ ਉਹ ਬੜੇ ਸ਼ੋਰਟਕੱਟ ਵੇਅ ਦੇ ਨਾਲ਼ ਮਤਲਬ ਬੜੀ ਜਲਦੀ ਤੋਂ ਜਲਦੀ ਉੱਥੇ ਮੈਨੂੰ ਲੈ ਗਏ ਠੀਕ ਹੈ ਅਤੇ ਬੜੀ ਸੇਫਲੀ ਡਰਾਈਵ ਵੀ ਕੀਤਾ ਉਹਨਾਂ ਨੇ ਅਤੇ ਨਾਲ਼ੇ ਮੈਂ ਆਪਣਾ ਸਮਾਨ ਭੁੱਲ ਗਿਆ ਜਲਦੀ ਜਲਦੀ ਦੇ ਵਿੱਚ ਉਤਰਨ ਲੱਗੇ ਤਾਂ ਉਹਨਾਂ ਨੇ ਮੈਨੂੰ ਵਾਪਸ ਕੋਲ ਕਰਕੇ ਉਹ ਮੈਨੂੰ ਸਮਾਨ ਵਾਪਸ ਦੇਣ ਆਏ ਮੇਰਾ ਅਤੇ ਇਸ ਕਰਕੇ ਮੈਨੂੰ ਬਹੁਤ ਅੱਛਾ ਲੱਗਿਆ ਠੀਕ ਹੈ ਅਤੇ ਉਹ ਤੋਂ ਬਾਅਦ ਮੈਂ ਉਹਨਾਂ ਨੂੰ ਕੁਛ ਇਨਾਮ ਵਜੋਂ ਕੁਛ ਦੇਣਾ ਵੀ ਚਾਹਿਆ ਪਰ ਉਹਨਾਂ ਨੇ ਬਿਲਕੁਲ ਇਨਕਾਰ ਕਰਤਾ ਕਿ ਮੇਰੀ ਇਹ ਡਿਊਟੀ ਸੀਗੀ ਤਾਂ ਇਸ ਕਰਕੇ ਮੈਂ ਉਹਨਾਂ ਦੇ ਲਈ ਬਹੁਤ ਸ਼ੁੱਭ ਇੱਛਾਵਾਂ ਦੇਣਾ ਚਾਹੁੰਦਾ ਅਤੇ ਉਹਨਾਂ ਦਾ ਇੱਕ ਅੱਛਾ ਫੀਡਬੈਕ ਮੇਰੇ ਵੱਲੋਂ ਦਰਜ ਕੀਤਾ ਜਾਵੇ ਥੈਂਕ ਯੂ